ਹਾਂਜੀ ਇਹ ਤਾਂ ਗੱਲ ਜੱਗ ਜ਼ਾਹਰ ਹੀ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਨਾ ਤਾਂ ਉਹ ਓਨੀ ਜ਼ਿਆਦਾ ਸੁਣੀ ਜਾਂਦੀ ਹੈ ਠੀਕ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਐਜੂਕੇਸ਼ਨ ਪੜ੍ਹਾਈ ਦੇ ਮਾਮਲੇ ਸਿੱਖਿਆ ਦੇ ਮਾਮਲੇ 'ਚ ਤਾਂ ਖਾਸ ਕਰਕੇ ਲੰਬੇ ਸਮੇਂ ਤੋਂ ਹੀ ਨਜ਼ਰ ਅੰਦਾਜ਼ ਕੀਤਾ ਹੀ ਜਾ ਰਿਹਾ ਠੀਕ ਹੈ ਜੀ ਉਹ ਕਿਵੇਂ ਦੇਖੋ ਤੁਸੀਂ ਹੁਣ ਇਨਫਰਾਸਟ੍ਰਕਚਰ ਦੀ ਗੱਲ ਕਰ ਲਉ ਤੁਸੀਂ ਸਹੂਲਤਾਂ ਦੀ ਗੱਲ ਕਰ ਲਉ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਿਜਲੀ ਤਾਂ ਚਲੋ ਹੁਣ ਫੇਰ ਵੀ ਆਉਣ ਲੱਗ ਗਈ ਹੈ ਪਰ ਪੂਰੀਆਂ ਕਲਾਸਾਂ ਨਹੀਂ ਬਣੀਆਂ ਹੁੰਦੀਆਂ ਵੌਸ਼ਰੂਮ ਟੋਇਲੇਟ ਪਾਣੀ ਦੀਆਂ ਸੁਵਿਧਾਵਾਂ ਇਹ ਸਮੱਸਿਆਵਾਂ ਨੇ ਜਿਹੜੀਆਂ ਤਾਂ ਬੇਸਿਕ ਹੀ ਨੇ ਜਿਹੜੀਆਂ ਕਿ ਹੋਣੀਆਂ ਨਹੀਂ ਚਾਹੀਦੀਆਂ ਕੁਛ ਪਿੱਛੇ ਜਿਹੇ ਸਮਾਰਟ ਸਕੂਲ ਬਣਾਏ ਵੀ ਗਏ ਪਰ ਉਹ ਸਮਾਰਟ ਸਕੂਲ ਸਿਰਫ ਰੰਗ ਕਰਕੇ ਬਣਾਏ ਗਏ ਰੰਗ ਕਰਕੇ ਲੋਕ ਕਹਿ ਦਿੰਦੇ ਨੇ ਸਕੂਲਾਂ 'ਚ ਉਹ ਹੋ ਗਿਆ ਸੁਧਾਰ ਹੋ ਗਿਆ ਪਰ ਰੰਗ ਰੁੰਗ ਨਾਲ ਥੋੜ੍ਹੀ ਚੀਜ਼ਾਂ ਬਦਲਦੀਆਂ ਨੇ ਟੀਚਰਾਂ ਦੀ ਜੇ ਗੱਲ ਕਰੀਏ ਟੀਚਰਾਂ ਦੀ ਕਈ ਜਗ੍ਹਾ ਤਾਂ ਸ਼ੋਰਟੇਜ ਬਹੁਤ ਹੈ ਮਤਲਬ ਹੈ ਹੀ ਨਹੀਂ ਪੂਰੇ ਨਹੀਂ ਹੈਗੇ ਕਈ ਜਗ੍ਹਾ ਜਿਹੜੇ ਹੈਗੇ ਨੇ ਪੁਰਾਣੇ ਨੇ ਜਿਹੜੇ ਬਹੁਤੇ ਉਹ ਪੜ੍ਹਾਉਣਾ ਨਹੀਂ ਚਾਹੁੰਦੇ ਹੈਗੇ ਉਹ ਉਹਨਾਂ ਨੂੰ ਇਹ ਹੈ ਕਿ ਵੀ ਅਸੀਂ ਤਾਂ ਪੱਕੇ ਹਾਂ ਰੈਗੂਲਰ ਹਾਂ ਕੋਈ ਤਨਖਾਹ ਨਹੀਂ ਉਹ ਹੋਣੀ ਕੋਈ ਚੱਕਰ ਨਹੀਂ ਹੈਗਾ ਪੜ੍ਹਾਉਂਦੇ ਨਹੀਂ ਹੈਗੇ ਬੱਚਿਆਂ ਨੂੰ ਬਾਕੀ ਉਹਨਾਂ ਦੀ ਵੀ ਮਜ਼ਬੂਰੀ ਹੈ ਇੱਕ ਇਹ ਨਹੀਂ ਕਿ ਕਹਿ ਸਕਦੇ ਆਪਾਂ ਇਕੱਲਾ ਉਹਨਾਂ ਦਾ ਦੋਸ਼ ਹੈ ਕਿਉਂਕਿ ਜਿਹੜੀ ਸਟੂਡੈਂਟ ਟੀਚਰ ਦੀ ਰੇਸ਼ੋ ਹੈ ਉਹਦੇ ਵਿੱਚ ਬਹੁਤ ਅੰਤਰ ਹੈ ਵੱਡਾ ਠੀਕ ਹੈ ਜੀ ਐਨੀ ਪਲਾ ਕਲਾਸ ਭਰੀ ਹੁੰਦੀ ਹੈ ਸੱਤਰ ਅੱਸੀ ਅੱਸੀ ਜਵਾਕ ਵੀ ਹੁੰਦੇ ਨੇ ਕਲਾਸਾਂ 'ਚ ਸੱਠ ਸੱਠ ਸੱਤਰ ਜਵਾਕ ਉਹਨਾਂ ਦੇ ਉੱਤੇ ਇੱਕ ਟੀਚਰ ਲਾ ਦਿਓਂਗੇ ਕਿੱਥੇ ਗੱਲ ਬਣਦੀ ਆ ਅਤੇ ਬਾਕੀ ਲੈਂਗੂਏਜ ਦਾ ਕਈ ਵਾਰ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਅਤੇ ਨਵੇਂ ਟੀਚਰ ਜਿਹੜੇ ਹੈਗੇ ਨੇ ਆਲੇ ਦੁਆਲੇ ਦੀ ਸਟੇਟਟਾਂ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਪੰਜਾਬੀ ਅਤੇ ਲੈਂਗੂਏਜ ਦਾ ਸਮੱਸਿਆਵਾਂ ਦਾ ਵੀ ਹੈਗਾ ਚੱਕਰ ਪਿੰਡਾਂ ਵਾਲੇ ਜਵਾਕ ਪੰਜਾਬੀ 'ਚ ਪੜ੍ਹਨਾ ਚਾਹੁੰਦੇ ਨੇ ਟੀਚਰ ਪੜ੍ਹੇ ਹੋਏ ਨੇ ਸਾਰੇ ਇੰਗਲਿਸ਼ ਮੀਡੀਅਮ 'ਚ ਉਹ ਇੰਗਲਿਸ਼ 'ਚ ਪੜ੍ਹਾਉਣਾ ਚਾਹੁੰਦੇ ਨੇ ਇਹ ਸਮੱਸਿਆ ਹੈਗੀ ਹੈ ਬਾਕੀ ਪਿੰਡਾਂ ਦੇ ਲੋਕਾਂ ਕੋਲ ਪੈਸਾ ਵੀ ਨਹੀਂ ਉਹ ਇਸ ਕਰਕੇ ਵਧੀਆ ਸਕੂਲਾਂ 'ਚ ਪੜ੍ਹਾ ਨਹੀਂ ਪਾਉਂਦੇ ਤਾਂ ਸਰਕਾਰੀ ਸਕੂਲਾਂ ਵੱਲ ਜਾਂਦੇ ਨੇ ਅਤੇ ਪਿੰਡਾਂ ਦੇ ਬੱਚੇ ਜਿਹੜੇ ਹੈਗੇ ਨੇ ਨਾ ਤਾਂ ਉਹ ਵਰਦੀਆਂ ਅਤੇ ਕਿਤਾਬਾਂ ਅਤੇ ਟਰਾਂਸਪੋਟੇਸ਼ਨ ਦੇ ਆਵਾਜਾਈ ਦੇ ਉੱਤੇ ਬਾਹਲਾ ਖਰਚ ਕਰ ਸਕਦੇ ਨੇ ਇਹ ਚੀਜ਼ਾਂ ਨੇ ਬਾਕੀ ਡਿਜੀਟਲ ਇੰਸਟਾਸਟਰੱਕਚਰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਮਾਰਟ ਕਲਾਸਾਂ ਹੁੰਦੀਆਂ ਨੇ ਉਹ ਤਾਂ ਬਹੁਤ ਹੀ ਦੂਰ ਹੈ ਪੇਂਡੂ ਖੇਤਰ ਤੋਂ ਉਹ ਸਿਰਫ ਸ਼ਹਿਰਾਂ ਵਾਲਿਆਂ ਨੂੰ ਹੀ ਸੁੱਖ ਮੰਨਣ ਦੀ ਮੰਨਣਾ ਮਿਲਦਾ ਉਹਨਾਂ ਦਾ ਪਿੰਡਾਂ ਵਾਲਿਆਂ ਨੂੰ ਤਾਂ ਕਿਤੇ ਵੀ ਪ੍ਰੋਜੈਕਟਰ ਵਗੈਰਾ ਕੀ ਨੇ ਇਹ ਨੇ ਬਾਕੀ ਜੇ ਆ ਜਾਂਦੇ ਨੇ ਤਾਂ ਪਿੰਡਾਂ ਦੇ ਜਵਾਕ ਥੋੜ੍ਹੇ ਜਿਹੇ ਇੱਲਤੀ ਵੀ ਆਪਾਂ ਕਹਿ ਸਕਦੇ ਹਾਂ ਇਸ ਮਾਮਲੇ 'ਚ ਹੈਗੇ ਨੇ ਜਿਹੜੇ ਕਈ ਤਾਂ ਹੈਗੇ ਨੇ ਸਹੀ ਐਂ ਨਹੀਂ ਕਿ ਸਾਰਿਆਂ ਨੂੰ ਇੱਕੋ ਥਾਲੀ 'ਚ ਨਹੀਂ ਆਪਾਂ ਪਾ ਸਕਦੇ ਕੁਛ ਜਿਹੜੇ ਹੈਗੇ ਨੇ ਵੀ ਉਹ ਫਿਰ ਉਹਨਾਂ ਨੂੰ ਵਰਤਣਾ ਵੀ ਨਹੀਂ ਆਉਂਦਾ ਹੈਗਾ ਤਾਂ ਉਹ ਚੀਜ਼ਾਂ ਸਿਖਾਉਣੀਆਂ ਵੀ ਪੈਣਗੀਆਂ ਉਹਨਾਂ ਨੂੰ ਠੀਕ ਹੈ ਜੀ ਉਹਦੇ ਹਿਸਾਬ ਨਾਲ ਕਮ ਚੀਜ਼ਾਂ ਹੈਗੀਆਂ ਜਿਹੜੀਆਂ ਚੱਲਣਗੀਆਂ ਬਾਕੀ ਮਿਡ ਡੇ ਮੀਲ ਵਗੈਰਾ ਕੁਛ ਪ੍ਰੋਗਰਾਮ ਵਧੀਆ ਲਿਆਂਦੇ ਗਏ ਨੇ ਜਿਹੜੇ ਕਿ ਪਿੰਡਾਂ ਦੇ ਵਿੱਚ ਖਾਣੇ ਖੁਣੇ ਦੀ ਗੱਲ ਚਲੋ ਖਾਣਾ ਵੱਖਰੀ ਗੱਲ ਹੈ ਪੜ੍ਹਾਈ ਵੱਖਰੀ ਗੱਲ ਹੈ ਸੋ ਪੜ੍ਹਾਈ ਦੇ ਉੱਤੇ ਕੰਮ ਜਿਹੜਾ ਹੈਗਾ ਬੜਾ ਘੱਟ ਹੋ ਰਿਹਾ